ਡਰਾਇੰਗ ਮੇਰੀ ਹੋਬੀ ਹੈ ਅਤੇ ਮੈਨੂੰ ਇਸ ਵਿੱਚ ਕਈ ਤਰ੍ਹਾਂ ਦੇ ਇਨਾਮ ਵੀ ਮਿਲੇ ਹਨ ਇੱਕ ਵਾਰ ਸਾਡੇ ਕਾਲਜ ਦੇ ਵਿੱਚ ਕੰਪਟੀਸ਼ਨ ਜੀਵਨ ਸਥਿਰ ਜੀਵਨ ਸੈਟ ਅਪ ਤੋਂ ਇੱਕ ਕੰਪੀਟੀਸ਼ਨ ਹੋਇਆ ਜਿਸ ਵਿੱਚ ਜੱਜਾਂ ਨੇ ਮੈਨੂੰ ਇੱਕ ਵਿਅਕਤੀ ਦੀ ਡਰਾਇੰਗ ਬਣਾਉਣ ਵਿੱਚ ਕਿਹਾ ਬਣਾਉਣ ਨੂੰ ਕਿਹਾ ਜਿਸ ਵਿੱਚ ਉਸਦੇ ਆਪਰੇਸ਼ਨ ਹਾਵ ਭਾਵ ਵੀ ਨਜ਼ਰ ਆਉਣ ਲਈ ਕਿਹਾ ਗਿਆ ਜਿਹੜਾ ਇਹ ਟਾਸਕ ਮੇਰੇ ਲਈ ਬਹੁਤ ਮੁਸ਼ਕਿਲ ਸੀ ਪਰ ਮੈਂ ਆਪਣੇ ਮਾਇੰਡ ਨੂੰ ਇਕਾਗਰ ਕਰਕੇ ਆਪਣੇ ਦਿਲੋਂ ਇਹ ਚਿੱਤਰ ਬਣਾਇਆ ਕਿ ਮੇਰੇ ਜੱਜਾਂ ਨੂੰ ਬਣਾਇਆ ਹੋਇਆ ਚਿੱਤਰ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਮੇਰੇ ਲਈ ਖੜ੍ਹੇ ਹੋ ਕੇ ਤਾੜੀਆਂ ਦੀ ਗਿਰਗਾਹਟ ਨਾਲ ਮੇਰਾ ਸਵਾਗਤ ਕੀਤਾ ਇਸ ਵਿੱਚ ਮੈਨੂੰ ਇੱਕ ਇਹ ਮੁਸ਼ਕਿਲ ਆਈ ਕਿ ਮੈਨੂੰ ਉਸ ਵਿਅਕਤੀ ਦੇ ਇਮਪਰੈਸ਼ਨ ਵੀ ਮੈਨੂੰ ਉਸ ਚਿੱਤਰ ਵਿੱਚ ਦਿਖਾਉਣੇ ਪਏ ਜੋ ਕਿ ਮੇਰੇ ਲਈ ਬਹੁਤ ਹੀ ਮੁਸ਼ਕਿਲ ਦਾ ਕੰਮ ਸੀ ਪਰ ਮੈਂ ਇਹ ਮੁਸ਼ਕਿਲ ਵਾਲਾ ਕੰਮ ਕਰਕੇ ਦਿਖਾਇਆ ਜਿਸ ਨਾਲ ਮੇਰੇ ਜਜਸ ਨੇ ਮੇਰਾ ਬਹੁਤ ਨਿੱਘਾ ਵਧੀਆ ਸੁਆਗਤ ਕੀਤਾ ਅਤੇ ਮੈਨੂੰ ਬਹੁਤ ਹੀ ਵਧੀਆ ਇਨਾਮ ਦਿੱਤਾ